ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਜੀ ਅੱਛਾ ਜੀ ਨਹੀਂ ਵੇਖੋ ਜੀ ਇੱਕ ਹਫਤੇ ਦੀ ਛੁੱਟੀ ਤਾਂ ਬਹੁਤ ਜ਼ਿਆਦੀ ਹੋ ਜਾਣੀ ਹੈ ਪਤਾ ਕੀ ਗੱਲ ਜੀ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜਾ ਸਿਲੇਬਸ ਆ ਉਹ ਕਾਫੀ ਚੱਲ ਰਿਹਾ ਫਿਰ ਇਹ ਸਿਲੇਬਸ ਤੋਂ ਪਿੱਛੇ ਰਹਿ ਜਾਵੇਗਾ ਪਰ ਫਿਰ ਵੀ ਜਿਹੜਾ ਹੋਮਵਰਕ ਆ ਜਿਹੜਾ ਇੱਥੇ ਹੋਣਾ ਵਾਂ ਉਹ ਕਲਾਸ ਦੇ ਵਿੱਚ ਬਹਿ ਕੇ ਬੱਚਿਆਂ ਨੇ ਕਰਨਾ ਵਾਂ ਉਹ ਤੁਹਾਡੇ ਕੋਲ ਉੱਥੇ ਟਰੇਨ ਦੇ ਵਿੱਚ ਥੋੜ੍ਹੀ ਹੋ ਜਾਵੇਗਾ ਬੱਚਾ ਤੁਹਾਡਾ ਪਹਿਲਾਂ ਹੀ ਕਾਫੀ ਵੀਕ ਚੱਲ ਰਿਹਾ ਵਾ ਨਹੀਂ ਜੇ ਤੁਸੀਂ ਦੋ ਤਿੰਨ ਦਿਨ ਦੀ ਕਹੋ ਤਾਂ ਦੋ ਤਿੰਨ ਦਿਨ ਤੱਕ ਤਾਂ ਠੀਕ ਹੈ ਐਡਜਸਟਮੈਂਟ ਹੋ ਹੋਜੂਗੀ ਵਿੱਚ ਉਸ ਤਰ੍ਹਾਂ ਵੀ ਇੱਕ ਅੱਧੀ ਛੁੱਟੀ ਆ ਜਾਵੇਗੀ ਸ਼ਨੀਵਾਰ ਦੀ ਜਾਂ ਐਤਵਾਰ ਦੀ ਅਤੇ ਬਾਕੀ ਤੁਸੀਂ ਆ ਜਿਓ ਸਕੂਲ ਫਿਰ ਬੈਠ ਕੇ ਆਪਾਂ ਗੱਲ ਕਰ ਲਵਾਂਗੇ ਹਾਂ ਠੀਕ ਹੈ ਠੀਕ ਹੈ